ਮੈਨੂੰ ਮਹਿਮਾਨ ਨਵਾਜ਼ੀ ਬੜੀ ਪਸੰਦ ਹੈ ਜਦੋਂ ਵੀ ਕੋਈ ਮੇਰੇ ਘਰ ਆਉਂਦਾ ਹੈ ਮੈਨੂੰ ਉਹਨਾਂ ਲਈ ਚਾਹ ਬਉਣੀ ਪਕੋੜੇ ਬਉਣੇ ਸਵੀਟਸ ਬਣਾਉਣੀਆਂ ਕਾਫੀ ਅੱਛੀਆਂ ਲੱਗਦੀਆਂ ਸੋ ਰੀਸੈਟਲੀ ਮੇਰੇ ਘਰ ਹੁਣੇ ਮੇਰੇ ਮਾਮਾ ਜੀ ਆਏ ਸੀ ਸੋ ਜਿਹਨਾਂ ਲਈ ਮੈਂ ਚਾਹ ਬਣਾਈ ਸੀ ਔਰ ਮੇਰੀ ਚਾਹ ਦੇ ਮੇਰੇ ਹੱਥਾਂ ਦੀ ਚਾਹ ਦੇ ਮੇਰੇ ਸਾਰੇ ਰਿਸ਼ਤੇਦਾਰ ਫੈਨ ਹੈ ਕਿਉਂਕਿ ਉਹਨਾਂ ਨੂੰ ਸਾਰਿਆਂ ਨੂੰ ਹੀ ਮੇਰੇ ਹੱਥਾਂ ਦੀ ਚਾਹ ਬੜੀ ਪਸੰਦ ਹੈ ਸੋ ਚਾਹ ਵੈਸੇ ਸਾਡੇ ਪੰਜਾਬ ਦੇ ਵਿੱਚ ਕਾਫੀ ਪੀਤੀ ਜਾਂਦੀ ਹੈ ਇਹਨੂੰ ਇੱਕ ਐਨਰਜੀ ਡ੍ਰਿੰਕ ਦੇ ਵਜੋਂ ਪੀਤਾ ਜਾਂਦਾ ਸੋ ਸਰਦੀਆਂ ਵਿੱਚ ਇਹਨੂੰ ਲੋਕੀਂ ਜ਼ਿਆਦਾ ਪੀਣਾ ਪਸੰਦ ਕਰਦੇ ਹੈ ਕਿਉਂਕਿ ਸਰਦੀਆਂ ਵਿੱਚ ਚਾਹ ਪੀਣ ਨਾਲ ਸਾਡੇ ਸਰੀਰ ਨੂੰ ਗਰਮੀ ਮਿਲਦੀ ਹੈ ਸੋ ਜਦੋਂ ਵੀ ਮੇਰੇ ਘਰ ਕੋਈ ਵੀ ਮਹਿਮਾਨ ਆਉਂਦਾ ਹੈ ਵੈਸੇ ਤਾਂ ਮੈਂ ਉਹਨਾਂ ਦੇ ਚੋਇਸ ਦੀ ਜਾਂ ਉਹਨਾਂ ਦੀ ਇੱਛਾਵਾਂ ਦਾ ਬਹੁਤ ਧਿਆਨ ਰੱਖਦੀ ਹਾਂ ਕਿਉਂਕਿ ਕਈ ਲੋਕ ਹੁੰਦੇ ਹਨ ਜਿਹਨਾਂ ਨੂੰ ਚਾਹ ਪੀਣੀ ਪਸੰਦ ਨਹੀਂ ਹੈ ਸੋ ਮੈਨੂੰ ਉਹਨਾਂ ਲਈ ਕੌਫੀ ਬਣਾਉਣੀ ਲਾਇਕ ਆ ਕੈਪਚੀਨੋ ਬਣਾਉਣਾ ਬਹੁਤ ਅੱਛਾ ਲੱਗਦਾ ਉਸ ਤੋਂ ਇਲਾਵਾ ਕਈ ਚਾਹ ਜਾਂ ਕੌਫੀ ਦੋਨੋ ਹੀ ਨਹੀਂ ਪੀਂਦੇ ਤਾਂ ਉਹਨਾਂ ਲਈ ਮੈਂ ਡਿਫ ਅ ਅਲੱਗ ਅਲੱਗ ਤਰਾਂ ਦੇ ਸ਼ੇਕਸ ਹੋ ਗਏ ਜਾਂ ਫਿਰ ਦੁੱਧ ਵਗੈਰਾ ਗਰਮ ਕਰਕੇ ਉਹਨਾਂ ਨੂੰ ਦੇਣਾ ਮੈਨੂੰ ਬਹੁਤ ਅੱਛਾ ਲੱਗਦਾ ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ ਸਵੀਟਸ ਦੇ ਵਿੱਚ ਤਾਂ ਮੈਨੂੰ ਗੁਲਾਬ ਜਾਮੁਣ ਹੋ ਗਈ ਰਸਗੁੱਲੇ ਹੋ ਗਏ ਰਸਮਲਾਈ ਹੋ ਗਈ ਪੇਸਟਰੀਸ ਹੋ ਗਈਆਂ ਕੇਕ ਹੋ ਗਏ ਇਹ ਐਵੇ ਦੀਆਂ ਜਿੰਨੀਆਂ ਵੀ ਡੀਜ਼ਰਟਸ ਹੈ ਗਾਜਰ ਦਾ ਹਲਵਾ ਹੋ ਗਿਆ ਮੂੰਗ ਦਾਲ ਦਾ ਹਲਵਾ ਹੋ ਗਿਆ ਇਹ ਸਾਰੇ ਡੀਜ਼ਰਟਸ ਬਣਾਉਣੇ ਮੈਨੂੰ ਬੜੇ ਪਸੰਦ ਹੈ ਅਤੇ ਜਿਹੜੇ ਵੀ ਮਹਿਮਾਨ ਮੇਰੇ ਘਰ ਆਉਂਦੇ ਆ ਉਹਨਾਂ ਨੂੰ ਮੈਂ ਮਿੱਠਾ ਅਤੇ ਨਮਕੀਨ ਖਵਾਏ ਬਿਨਾਂ ਨਹੀਂ ਭੇਜਦੀ ਔਰ ਉਹਨਾਂ ਸਾਰਿਆਂ ਨੂੰ ਹੀ ਮੇਰੀ ਮਹਿਮਾਨ ਨਵਾਜ਼ੀ ਬਹੁਤ ਵਧੀਆ ਲਗਦੀ ਹੈ ਜਿਸ ਕਰਕੇ ਮੇਰੇ ਘਰ ਹਰ ਹਫਤਿਆਂ ਕੋਈ ਨਾ ਕੋਈ ਮਹਿਮਾਨ ਜ਼ਰੂਰ ਆਉਂਦਾ ਹੈ ਮੇਰੀ ਮਹਿਮਾਨ ਨਵਾਜ਼ੀ ਨੂੰ ਦੇਖਣ ਤੋਂ ਬਾਅਦ ਔਰ ਉਹਨਾਂ ਸਾਰਿਆਂ ਦੇ ਕਾਫੀ ਅੱਛੇ ਵਿਊਜ਼ ਹੁੰਦੇ ਹੈ ਮੇਰੀ ਮਹਿਮਾਨ ਨਵਾਜ਼ੀ ਨੂੰ ਲੈ ਕੇ ਸੋ ਇਸ ਤੋਂ ਇਲਾਵਾ ਵੀ ਅਗਰ ਕੋਈ ਮਹਿਮਾਨ ਮੇਰੇ ਘਰ ਦੁਪਹਿਰ ਦੇ ਖਾਣ ਦੇ ਟਾਇਮ ਜਾਂ ਰਾਤ ਦੇ ਖਾਣ ਦੇ ਟਾਇਮ ਪਹੁੰਚਦੇ ਹਨ ਤਾਂ ਉਹਨਾਂ ਨੂੰ ਮੈਂ ਦੁਪਹਿਰ ਦਾ ਖਾਣਾ ਅਤੇ ਰਾਤ ਦਾ ਖਾਣਾ ਬਣਾ ਕੇ ਵੀ ਖਵਾਉਂਦੀ ਹਾਂ ਅਤੇ ਜਿਹਦੇ ਵਿੱਚ ਮੈਂ ਸ਼ਪੈਸ਼ਲੀ ਸ਼ਾਹੀ ਪਨੀਰ ਹੋ ਗਿਆ ਦਾਲ ਮੱਖਣੀ ਹੋ ਗਿਆ ਰਲੀ ਮਿਲੀ ਸਬਜ਼ੀ ਹੋ ਗਈ ਇਸ ਤੋਂ ਇਲਾਵਾ ਰਾਈਤਾ ਹੋ ਗਿਆ ਚਾਵਲ ਹੋ ਗਏ ਕਈ ਤਰ੍ਹਾਂ ਦੇ ਅ ਰੋਟੀਆਂ ਹੋ ਗਈਆਂ ਭਟੂਰੇ ਹੋ ਗਏ ਜਾਂ ਪੂਰੀਆਂ ਹੋ ਗਈਆਂ ਇਹ ਸਾਰੀਆਂ ਚੀਜ਼ਾਂ ਬਣਾ ਕੇ ਮੈਨੂੰ ਉਹਨਾਂ ਨੂੰ ਖਵਾਣਾ ਬਹੁਤ ਪਸੰਦ ਹੈ